ਮੈਨੂੰ ਦੋਨੋਂ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ ਪਸੰਦ ਹਨ ਇਨਡੋਰ ਵੀ ਅਤੇ ਆਊਟਡੋਰ ਵੀ ਆਊਟਡੋਰ ਖੇਡਾਂ ਮੈਂ ਆਪਣੇ ਫਰੈਂਡਸ ਦੇ ਨਾਲ ਖੇਡਦੀ ਹਾਂ ਪਰ ਇੰਡੋਰ ਖੇਡਾਂ ਜਿਵੇਂ ਕਿ ਲੁੱਡੋ ਕੈਰਮ ਸੱਪ ਅਤੇ ਪੌੜੀ ਮੈਂ ਆਪਣੇ ਦਿਮਾਗ ਨੂੰ ਸ਼ਾਂਤ ਕਰਨ ਲਈ ਜਾਂ ਫਿਰ ਮੈਂ ਇਕੱਲੀ ਹੋਵਾਂ ਅਤੇ ਆਪਣੇ ਦਿਮਾਗ ਦੀ ਐਕਸਰਸਾਈਜ਼ ਕਰਨ ਲਈ ਖੇਡਦੀ ਹਾਂ ਜਿਸ ਨਾਲ ਮੈਨੂੰ ਬਹੁਤ ਆਨੰਦ ਮਿਲਦਾ ਹੈ